ਜਿਵੇਂ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ ਵਿੱਚ ਰੀਤੀ ਰਿਵਾਜਾਂ ਨੇ ਨੂੰ ਬਹੁਤ ਮੰਨਿਆ ਜਾਂਦਾ ਸੀ ਪਰ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਰੀਤੀ ਰਿਵਾਜਾਂ ਨੂੰ ਘੱਟ ਅਪਣਾਉਂਦੀ ਹੈ ਕਿਉਂਕਿ ਉਹਨਾਂ ਨੂੰ ਇਹਨਾਂ ਰੀਤੀ ਰਿਵਾਜਾਂ ਦੇ ਪਿੱਛੇ ਦੇ ਜਿਹੜੇ ਕਾਰਨ ਹੈ ਉਹ ਚੰਗੀ ਤਰ੍ਹਾਂ ਨਹੀਂ ਪਤਾ ਹੈਗੇ ਇਸ ਕਰਕੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਸੱਭਿਆਚਾਰਕ ਜਿਹੜੇ ਰੀਤੀ ਰਿਵਾਜ ਹੈ ਉਹਨਾਂ ਦੀ ਪਾਲਣਾ ਘੱਟ ਕਰਦੇ ਹੈ ਅਤੇ ਆਪਣੇ ਹੀ ਕੁਛ ਨਾ ਕੁਛ ਤਰੀਕੇ ਅਪਣਾਉਂਦੀ ਰਹਿੰਦੀ ਹੈ ਸਾਡਾ ਸੱਭਿਆਚਾਰ ਜਿਹੜਾ ਬਹੁਤ ਹੀ ਪਿੱਛੜਦਾ ਜਾ ਰਿਹਾ ਜਿਸ ਕਰਕੇ ਸਾਨੂੰ ਇਸ ਨੂੰ ਦੁਬਾਰਾ ਅਪਣਾਉਣ ਦੀ ਲੋੜ ਹੈ ਇਸ ਨੂੰ ਦੁਬਾਰਾ ਅਪਣਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਅਸੀਂ ਪਿਛਲੇ ਸਮੇਂ ਵਿੱਚ ਦੇਖਦੇ ਸੀ ਕਿ ਜਿਹੜੇ ਪਿੰਡਾਂ ਦੇ ਨਿਆਣੇ ਹੁੰਦੇ ਸੀ ਉਹ ਕਿਸੇ ਪਿੰਡ ਦੀ ਉੱਚੀ ਥਾਂ 'ਤੇ ਜਾ ਕੇ ਇਕੱਠੇ ਖੇਡਦੇ ਸੀ ਅਤੇ ਜਿਹੜੇ ਸਿਆਣੇ ਬੁੱਢੇ ਹੁੰਦੇ ਸੀ ਉਹ ਇਕੱਠੇ ਬਹਿ ਕੇ ਜਿਹੜੇ ਆ ਉਹ ਗੱਲਾਂ ਮਾਰਦੇ ਸੀ ਅਤੇ ਜਨਾਨੀਆਂ ਜਿਹੜੀਆਂ ਆ ਉਹ ਉਹਨਾਂ ਵਿੱਚ ਸ਼ਰਮ ਲਿਹਾਜ ਹੁੰਦੀ ਸੀ ਅਤੇ ਉਹ ਜਦੋਂ ਰੀਤੀ ਰਿਵਾਜਾਂ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੀਆਂ ਸੀ ਉਹਨਾਂ ਦੀ ਪਾਲਣਾ ਕਰਦੀਆਂ ਸੀ ਪਰ ਜੇ ਅਸੀਂ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ ਉਹ ਅੱਜ ਕੱਲ੍ਹ ਸਮਾਂ ਘੱਟ ਗਿਆ ਹੈ ਜਿੱਥੇ ਕਿ ਲੋਕਾਂ 'ਚ ਪਿਆਰ ਵੀ ਨਹੀਂ ਰਿਹਾ ਇਸ ਕਰਕੇ ਸਾਡੀ ਸੱਭਿਆਚਾਰਕ ਕਦਰਾਂ ਕੀਮਤਾਂ ਜਿਹੜੀਆਂ ਆ ਉਹ ਢਿੱਲੀਆਂ ਪੈ ਰਹੀਆਂ ਆ ਅਤੇ ਸਾਨੂੰ ਇਹਨਾਂ ਨੂੰ ਦੁਬਾਰਾ ਅਪਣਾਉਣ ਦੀ ਲੋੜ ਹੈ ਅਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਸਾਡੇ ਪੰਜਾਬੀ ਜਿਹੜੇ ਸੱਭਿਆਚਾਰਕ ਰੀਤਾਂ ਆ ਉਹਨਾਂ ਨੂੰ ਅਸੀਂ ਫਿਰ ਦੁਬਾਰਾ ਅਪਣਾ ਸਕੀਏ ਅਤੇ ਫਿਰ ਦੁਬਾਰਾ ਆਪਣੇ ਪੰਜਾਬ ਵਿੱਚ ਮੁੜ ਲੈ ਆ ਸਕੀਏ